ਦੋ ਮਈ ਉੱਨੀ ਚੌਰਾਸੀ ਦਸ ਮਾਰਚ ਉੱਨੀ ਅਠੱਨਵੇ ਵੀਹ ਅਪ੍ਰੈਲ ਵੀਹ ਬਾਰਾਂ ਸਤਾਰਾਂ ਸਤੰਬਰ ਵੀਹ ਅਠਾਰਾਂ ਤੀਹ ਅਕਤੂਬਰ ਵੀਹ ਬਾਈ